ਠੀਕ ਠੀਕ ਤੂੰ ਸੁਣਾ ਆ ਗਿਆ ਰਿਜਲਟ ਵਗੈਰਾ ਅੱਛਾ ਅਤੇ ਮੇਰੇ ਤਾਂ ਵਧੀਆ ਹੀ ਗਏ ਵੈਸੇ ਦੇਖੋ ਕੀ ਆਉਂਦਾ ਰਿਜਲਟ ਕੀ ਸੋਚਿਆ ਅੱਗੇ ਬਾਰੇ ਇੰਜਨੀਅਰਿੰਗ ਕਰਨੀ ਤੂੰ ਵੀ ਹੈ ਮੈਂ ਵੀ ਇੰਜੀਨੀਅਰਿੰਗ ਕਰੂੰਗਾ ਪਰ ਮੇਰੇ ਪਾਪਾ ਕਿਹਾ ਕਰਦੇ ਹੈ ਕਿ ਸ਼੍ਰੀ ਸਾਈ ਜਿਹੜਾ ਕਾਲਜ ਹੈ ਨਾ ਵਧੀਆ ਉਹ ਥੋੜ੍ਹਾ ਇੰਜੀਨੀਅਰਿੰਗ ਵਾਸਤੇ ਲੋਕਲ ਵੀ ਹੋ ਜਾਏਗਾ ਅਤੇ ਪੜ੍ਹਾਈ ਵੀ ਚੰਗੀ ਆ ਪਲੇਸਮੈਂਟ ਵਗੈਰਾ ਵੀ ਉੱਥੇ ਬਾਕੀ ਤਾਂ ਸਕਿੱਲਾਂ 'ਤੇ ਹੀ ਡਿਪੈਂਡ ਕਰਦਾ ਹਾਂ ਅਤੇ ਨਾ ਨਾ ਹਜੇ ਸੋਚਿਆ ਕਰਦੇ ਬਸ ਤੂੰ ਵੀ ਸੋਚ ਲਾ ਫਿਰ ਨਾਲ ਹੀ ਕਰਾਂ ਲਾਂਗੇ ਤੂੰ ਵੀ ਕਰਾਉਣੀ ਹੋਈ ਕਿਤੇ ਰਿਜਲਟ 'ਚ ਪਾਸ ਤਾਂ ਹੋ ਹੀ ਜਾਣਾ

ਹਾਂ ਠੀਕ ਹੈ ਠੀਕ ਹੈ ਠੀਕ ਹੈ ਫੀਸ਼ ਵਗੈਰਾ ਵੀ ਠੀਕ ਠਾਕ ਹੀ ਹੈ ਉੱਥੇ ਜ਼ਿਆਦਾ ਵੀ ਨਹੀਂ ਹੈ ਘੱਟ ਵੀ ਨਹੀਂ ਹੈ ਵਧੀਆ ਕੋਲਜ ਹੈ ਸਹੀ ਗੱਲ ਆ ਹਾਂ ਕੰਪਿਊਟਰ ਸਾਇੰਸ 'ਚ ਸੋਚੀ ਆ ਮੈਂ ਤੂੰ ਬਿਲਕੁਲ ਸਹੀ ਗੱਲ ਆ ਡਿਵੈਲਪਮੈਂਟ ਫੈਕਟ ਤੋਂ ਚੰਗੀ ਜੋਬ ਹੈ ਅੱਜ ਦੇ ਜਮਾਨੇ 'ਚ ਤਾਂ ਸ਼੍ਰੀ ਸਾਈ ਕਾਲਜ ਹੋ ਗਿਆ ਅਤੇ ਬਾਕੀ ਇੱਕ ਦੋ ਹੋਰ ਨੇ ਕੋਲਜ ਨਹੀਂ ਤਾਂ ਬਾਹਰ ਵੀ ਆ ਸਕਦੇ ਆ ਆਪਾਂ ਫਿਰ ਪਠਾਨਕੋਟ ਤੇ ਦੇਖਦੇ ਆ ਨਾ ਫਿਰ ਸ਼੍ਰੀ ਸਾਈ ਕੋਲਜ ਏ ਐਂਡ ਐੱਮ ਹੋ ਗਿਆ ਏਏ ਐਂਡ ਐੱਮ ਏ ਐਂਡ ਐੱਮ 'ਚ ਹੈਗੀ ਕੋਈ ਟੈਸਟ ਅੱਛਾ ਅੱਛਾ ਅੱਛਾ ਅੱਛਾ ਸ਼੍ਰੀ ਸਾਈ ਹੈਗਾ ਸਹੀ ਗੱਲ ਆ ਹੋਰ ਹਾਂ ਹਾਂ ਠੀਕ ਆ ਹਾਂ ਹਾਂ ਠੀਕ ਆ ਠੀਕ ਆ ਮੈਂ ਦੇਖੇ ਵੇ ਨੇ ਮੈਂ ਜੇ ਪੰਜ ਛੇ ਜਾਵਾਂਗਾ ਜਾਂ ਫਿਰ ਓਕੇ ਓਕੇ ਚੰਗਾ ਬਾਏ ਬਾਏ